ਬਜ਼ੁਰਗ ਲੋਗ ਦਿਮਾਗੀ ਖੇਡਾਂ ਖੇਡਦੇ ਹਨ ਜਿਹਨਾਂ ਨਾਲ ਦਿਮਾਗ ਦੀ ਕਸਰਤ ਹੁੰਦੀ ਹੈ ਬਜ਼ੁਰਗ ਲੋਕ ਇਕੱਠੇ ਹੋ ਕੇ ਤਾਸ਼ ਮਤਲਬ ਕਿ ਪਲੇਇੰਗ ਕਾਰਡਸ ਖੇਡਦੇ ਹਨ ਜੋ ਕੀ ਇੱਕ ਦਿਮਾਗੀ ਖੇਡ ਹੈ ਇਸ ਵਿੱਚ ਉਹ ਸ਼ੀਪ ਰੰਮੀ ਵਗੈਰਾ ਖੇਡਦੇ ਹਨ ਕੁਝ ਬਜ਼ੁਰਗ ਲੋਕ ਸ਼ਤਰੰਜ ਵੀ ਖੇਡਦੇ ਹਨ ਕੈਰਮ ਬੋਰਡ ਲੁੱਡੋ ਉਹ ਵੀ ਖੇਡਦੇ ਹਨ ਅਤੇ ਕੁਝ ਬਜ਼ੁਰਗਾਂ ਨੂੰ ਮੈਂ ਰੋੜਿਆਂ ਨਾਲ ਖੇਡਦੇ ਵੀ ਦੇਖਿਆ ਹੈ